ਹੈਲੋ ਹਾਂਜੀ ਕੌਣ ਹਾਂਜੀ ਹਾਂਜੀ ਦੱਸੋ ਅੱਛਾ ਹਾਂਜੀ ਹਾਂਜੀ ਕੋਈ ਈਸ਼ੂ ਨਹੀਂ ਹਾਂਜੀ ਹਾਂਜੀ ਮਤਲਬ ਜਿੱਦਾਂ ਹੁਣ ਤੁਸ ਤੁਸੀਂ ਗੱਲ ਹੀ ਕੀਤੀ ਆ ਘੁੰਮਣ ਫਿਰਨ ਦੀ ਅਤੇ ਗੁਰਦੁਆਰੇ ਜਿੱਦਾਂ ਹੁਣ ਸਟੇਟ ਗੁਰਦੁਆਰਾ ਹੋ ਗਿਆ ਸਤਿਆਨਾਰਾਇਣ ਮੰਦਰ ਹੋ ਗਿਆ ਕਪੂਰਥਲੇ 'ਚ ਹੋਰ ਹੋਰ ਸੁਲਤਾਨਪੁਰ ਵਾਲੀ ਸਾਈਡ ਵੀ ਹੈਗੇ ਆ ਗੁਰਦੁਆਰਾ ਬੇਰ ਸਾਹਿਬ ਹੈਗਾ ਆ ਹੋਰ ਵੀ ਬੜੇ ਗੁਰਦੁਆਰੇ ਆ ਉੱਥੇ ਮਤਲਬ ਹੁਣ ਤੁਸੀਂ ਕਿ ਮਤਲਬ ਤੁਸੀਂ ਆਪਣੇ ਆਪ ਜਾਣਾ ਆ ਜਾਂ ਮੈਨੂੰ ਲੈ ਕੇ ਮਤਲਬ ਕਿ ਮੈਂ ਜਾਊਂਗਾ ਤੁਹਾਡੇ ਨਾਲ ਤੁਹਾਨੂੰ ਗਾਈਡ ਕਰਨ ਵਾਸਤੇ ਓਕੇ ਓਕੇ ਹਾਂਜੀ ਹਾਂਜੀ ਉਹ ਤਾਂ ਫਿਰ ਡਿਪੈਂਡ ਕਰਦਾ ਹੈ ਕਿ ਮਤਲਬ ਜਗ੍ਹਾ ਜਗ੍ਹਾ 'ਤੇ ਨਾ ਕਿ ਹੁਣ ਜਿੱਦਾਂ ਜੇ ਤਾਂ ਕਪੂਰਥਲੇ ਦੇ ਵਿੱਚ ਵਿੱਚ ਹੈ ਫਿਰ ਤਾਂ ਫਾਈਵ ਹੰਡਰਡ ਫਾਈਵ ਹੰਡਰਡ ਹੈ ਠੀਕ ਹੈ ਜਿੱਦਾਂ ਹੁਣ ਜੇ ਅਸੀਂ ਸੁਲਤਾਨਪੁਰ ਵਾਲੀ ਸਾਈਡ ਜਾਣਾ ਹੈ ਕਿਤੇ ਹੋਰ ਜਾਣਾ ਤਾਂ ਫਿਰ ਉਹਦਾ ਬਣ ਜਾਂਦਾ ਆ ਸਿਕਸ ਹੰਡਰਡ